ਵਿਕਾਸ ਕੁਦਰਤ ਦਾ ਨਿਯਮ ਹੈ ਖੇਡਾਂ ਦੇ ਵਿਕਸਿਤ ਹੋਣ ਨਾਲ ਇਹਨਾਂ ਵਿੱਚ ਬਦਲਾਅ ਵੀ ਆਇਆ ਜਿਵੇਂ ਸਾਡੀਆਂ ਪੁਰਾਤਨ ਖੇਡਾਂ ਖੇਡੋ ਖੁੱਡੀ ਕੱਚੀ ਗਰਾਊਂਡ ਵਿੱਚ ਖੇਡੀ ਜਾਣ ਵਾਲੀ ਖੇਡ ਸੀ ਪਰ ਅੱਜ ਉਹ ਐਸੋ ਟਰਾਫ ਹਾਕੀ ਦੇ ਰੂਪ ਵਿੱਚ ਸਾਹਮਣੇ ਆਈ ਗੱਤਕਾ ਵੀ ਪੁਰਾਣੇ ਸਮੇਂ ਵਿੱਚ ਧਾਰਮਿਕ ਪ੍ਰੇਰਨਾ ਮੁਤਾਬਕ ਖਾਸ ਵਰਗ ਵੱਲੋਂ ਖੇਡਿਆ ਜਾਂਦਾ ਸੀ ਪਰ ਅੱਜ ਇਸ ਨੂੰ ਦੂਜੀਆਂ ਖੇਡਾਂ ਵਾਂਗ ਸਕੂਲ ਸਮੇਂ ਤੋਂ ਹੀ ਕੋਚ ਦੁਆਰਾ ਸਿਖਲਾਈ ਦੇ ਕੇ ਖੇਡਿਆ ਜਾਣ ਲੱਗਾ ਇਸ ਤਰ੍ਹਾਂ ਹੋਰ ਖੇਡਾਂ ਕ੍ਰਿਕਟ ਕਬੱਡੀ ਫੁੱਟਬਾਲ ਜਿੰਮਨਾਸਟਿਕ ਤੀਰ ਅੰਦਾਜ਼ੀ ਵੀ ਕਈ ਤਰ੍ਹਾਂ ਦੇ ਬਦਲਾਉ ਦੇਖਣ ਨੂੰ ਆਉਂਦੇ ਹਨ ਇਸ ਦੇ ਨਾਲ ਨਾਲ ਆਧੁਨਿਕ ਟੈਕਨੋਲੋਜੀ ਕਾਰਨ ਈ ਸਪੋਰਟਸ ਦਾ ਵੀ ਸਮਾਜ ਵਿੱਚ ਬੋਲ ਬਾਲਾ ਹੈ ਅੱਜ ਦੇ ਸਮੇਂ ਵਿੱਚ ਅੰਗਹੀਣ ਵਿਅਕਤੀ ਦੀ ਖੇਡ ਸੱਭਿਆਚਾਰ ਵਿੱਚ ਆਪਣਾ ਯੋਗਦਾਨ ਪਾਇਆ ਵਿੱਚ ਪਿੱਛੇ ਨਹੀਂ ਰਿਹਾ ਸਗੋਂ ਉਹ ਵੀ ਇੱਕ ਨਵੀਆਂ ਨਵੀਆਂ ਤਕਨੀਕਾਂ ਨਾਲ ਖੇਡ ਵਿੱਚ ਮੱਲਾਂ ਮਾਰ ਰਹੇ ਹਨ